ਜਦੋਂ ਵੀ ਮੈਨੂੰ ਆਪਣੇ ਕੰਮ ਕਾਰ ਤੋਂ ਖਾਲੀ ਸਮਾਂ ਮਿਲਦਾ ਹੈ ਜਾਂ ਮੈਂ ਕਦੀ ਵੀ ਖਾਲੀ ਬੈਠੀ ਹੁੰਦੀ ਹਾਂ ਤਾਂ ਮੈਂ ਰੀਲਸ ਦੇਖਣਾ ਪਸੰਦ ਕਰ ਲੈਂਦੀ ਹਾਂ ਤਾਂ ਕਈ ਵਾਰ ਮੈਂ ਡਾਂਸ ਰੀਲਜ਼ ਵੀ ਦੇਖ ਲੈਂਦੀ ਹਾਂ ਪਰ ਅਜਿਹਾ ਕੋਈ ਮੇਰਾ ਪ੍ਰਸੰਸੀ ਪਸੰਦੀਦਾ ਡਾਂਸਰ ਤਾਂ ਨਹੀਂ ਹੈ ਫਿਰ ਵੀ ਜਦੋਂ ਵੀ ਮੈਂ ਰੀਲਜ਼ ਦੇਖਦੀ ਹਾਂ ਜੇ ਮੈਨੂੰ ਕੋਈ ਅੱਛੇ ਡਾਂਸ ਸਟੈੱਪ ਲੱਗੇ ਹਨ ਅੱਛਾ ਡਾਂਸਰ ਲੱਗਿਆ ਹੈ ਉਹਦਾ ਡਾਂਸ ਦਾ ਸਟਾਈਲ ਬਹੁਤ ਅੱਛਾ ਲੱਗਿਆ ਹੈ ਮੈਂ ਜ਼ਰੂਰ ਉਸ ਨੂੰ ਦੇਖਣਾ ਪਸੰਦ ਕਰਦੀ ਹਾਂ